ਸਾਡੇ ਪਿੰਡ ਦੇ ਲੋਕਾਂ ਦੇ ਵਿੱਚ ਕਰਜ਼ਾ ਲੈਣਾ ਬਹੁਤ ਜ਼ਿਆਦਾ ਆਮ ਗੱਲ ਵੀ ਕਹਿ ਸਕਦੇ ਹਾਂ ਪਰ ਬਹੁਤ ਜ਼ਿਆਦਾ ਤਕਲੀਫਦਾਇਕ ਗੱਲ ਵੀ ਕਹਿ ਸਕਦੇ ਹਾਂ ਆਪਾਂ ਆਮ ਗੱਲ ਤਾਂ ਆਪਣੇ ਪਿੰਡ ਦੇ ਵਿੱਚ ਇਹ ਆ ਕਿ ਜ਼ਿਆਦਾਤਰ ਸਾਡੇ ਪਿੰਡ ਵਿੱਚ ਮੱਧ ਵਰਗ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਕਿ ਕਰਜ਼ਾ ਲੈਣਾ ਜਾ ਪੈਂਦਾ ਹੈ ਘਰ ਦੀਆਂ ਉਹਨਾਂ ਦੀਆਂ ਲੋੜਾਂ ਕਹਿ ਸਕਦੇ ਹਾਂ ਇੰਨੀਆਂ ਜ਼ਿਆਦਾ ਨੇ ਅਤੇ ਉਹਨੇ ਪੂਰੀਆਂ ਨਹੀਂ ਆਉਂਦੇ ਪੂਰੀਆਂ ਨਾ ਹੋਣ ਦੇ ਕਾਰਨ ਬਾਵਜੂਦ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਕਈ ਗਰੀਬ ਪਰਿਵਾਰ ਨੇ ਉਹਨਾਂ ਨੂੰ ਆਪਣੀ ਕੁੜੀ ਦੇ ਵਿਆਹ ਲਈ ਜਾਂ ਕੋਈ ਮੱਧ ਵਰਗ ਦੇ ਲੋਕ ਨੇ ਉਹਨਾਂ ਨੂੰ ਖੇਤੀ ਦੇ ਵਿੱਚ ਯੋਗਦਾਨ ਲਈ ਜਾਂ ਟਰੈਕਟਰ ਵਗੈਰਾ ਲੈਣ ਲਈ ਉਹਨਾਂ ਨੂੰ ਕਰਜ਼ਾ ਲੈਣ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ ਉਹ ਕਰਜ਼ਾ ਫਿਰ ਸਾਡੇ ਪਿੰਡ ਦੇ ਕਈ ਵੱਡੇ ਲੋਕ ਨੇ ਜਿਹੜੇ ਬੈਂਕਾਂ ਦੀ ਸਹਾਇਤਾ ਲੈਂਦੇ ਨੇ ਕਰਜ਼ਾ ਲੈਣ ਦੇ ਲਈ ਜਾਂ ਜਿਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ ਮਿਲ ਵੀ ਜਾਂਦਾ ਹੈ ਪਰ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਨੂੰ ਕਰਜ਼ਾ ਲੈਣ ਵਿੱਚ ਦੋ ਦੋ ਤਿੰਨ ਤਿੰਨ ਮਹੀਨੇ ਤਾਂ ਗੇੜੇ ਹੀ ਮਾਰਨੇ ਪੈਂਦੇ ਨੇ ਉਸ ਬੈਂਕ 'ਚ ਅਤੇ ਫਿਰ ਉਹਨਾਂ ਨੂੰ ਮਸਾਂ ਲੱਖ ਦਾ ਦੋ ਲੱਖ ਦਾ ਕਰਜ਼ਾ ਮਿਲਦਾ ਅਤੇ ਇਸ ਤੋਂ ਬਾਅਦ ਫਿਰ ਉਹਨਾਂ ਤੋਂ ਕਰਜ਼ਾ ਵੀ ਉਤਾਰਿਆ ਨਹੀਂ ਜਾਂਦਾ ਸੋ ਅਤੇ ਬਾਕੀ ਫਿਰ ਇਸ ਕਰਕੇ ਬੈਂਕ ਤੋਂ ਕਰਜ਼ਾ ਲੈਣ ਦੀ ਬਜਾਏ ਲੋਕ ਉੱਥੇ ਵਿਆਜ ਦੀ ਦਰ ਘੱਟ ਹੁੰਦੀ ਹੈ ਲੋਕ ਕੀ ਕਰਦੇ ਨੇ ਜਦੋਂ ਬੈਂਕ ਤੋਂ ਕਰਜ਼ਾ ਘੱਟ ਮਿਲਦਾ ਤਾਂ ਬ ਆ ਸਾਡੇ ਪਿੰਡ ਦੇ ਜੋ ਸ਼ਾਹੂਕਾਰ ਨੇ ਆੜਤੀਏ ਵੀ ਕਹਿ ਸਕਦੇ ਹਾਂ ਆਪਾਂ ਲੋਕਾਂ ਦੇ ਉਹਨਾਂ ਤੋਂ ਕਰਜ਼ਾ ਲੈਂਦੇ ਨੇ ਜੋ ਕਿ ਉਹਨਾਂ ਦੀ ਵਿਆਜ ਦੀ ਦਰ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਵਿਆਜ ਦੀਆਂ ਦਰਾਂ ਨੂੰ ਨਾ ਪੂਰਾ ਕਰਨ ਦੇ ਬਾਵਜੂਦ ਨਾ ਤਾਂ ਉਹ ਪੂਰਾ ਕਰ ਸਕਦੇ ਨੇ ਅਤੇ ਉਹਨਾਂ ਨੂੰ ਆਪਣੇ ਖਰਚੇ ਵੀ ਘਰ ਦੇ ਪੂਰੇ ਨਹੀਂ ਹੁੰਦੇ ਅਤੇ ਇਸ ਤੋਂ ਬਾਅਦ ਫਿਰ ਉਹ ਆਪਣੇ ਆਪ ਨੂੰ ਇਸ ਜ਼ਿੰਦਗੀ ਤੋਂ ਨਿਸ਼ਾਵਰ ਕਰਨਾ ਹੀ ਬਹੁਤ ਜ਼ਿਆਦਾ ਚੰਗਾ ਮੰਨਦੇ ਨੇ ਅਤੇ ਸੋ ਇਹ ਹੀ ਸਾਡੇ ਪਿੰਡ ਦਾ ਹਾਲ ਹੈ ਬੁਰਾ ਹਾਲ ਹੈ ਅਸੀਂ ਕਰਜੇ ਕਰਨ ਲਈ ਬੈਂਕਾਂ ਨਾਲ ਅਤੇ ਆੜਤੀਏ ਨਾਲ ਸੰਪਰਕ ਕਰਦੇ ਨੇ ਅਤੇ ਮਾੜੇ ਪ੍ਰਭਾਵ ਕਰਜ਼ੇ ਦੇ ਇਹ ਹੀ ਨੇ ਕਿ ਜਦੋਂ ਕਿਸੇ ਨੇ ਕਰਜ਼ਾ ਲੈ ਲਿਆ ਤਾਂ ਉਹਨਾਂ ਦੇ ਵਿ ਕੋਲੋਂ ਕਰਜ਼ਾ ਦਾ ਵਿਆਜ ਹੀ ਇੰਨਾ ਜ਼ਿਆਦਾ ਹੋ ਜਾਂਦਾ ਕਿ ਉਹਨਾਂ ਤੋਂ ਮੋੜਿਆ ਨਹੀਂ ਜਾਂਦਾ ਅਤੇ ਜਿਹਦੇ ਨਾਲ ਉਹ ਆਪਣੇ ਆਪ ਦੀ ਜ਼ਿੰਦਗੀ ਨੂੰ ਫਾਹਾ ਲੈਣ ਜਾਂ ਆਤਮ ਹੱਤਿਆ ਕਰਨ ਦੇ ਲਈ ਇੰਨੇ ਮਜਬੂਰ ਹੋ ਜਾਂਦੇ ਨੇ ਇਹ ਹੀ ਮਾੜੇ ਕਰਜ਼ੇ ਦੇ ਮਾੜੇ ਪ੍ਰਭਾਵ ਨੇ ਜੇ ਕਰਜ਼ਾ ਨਾ ਹੋਵੇ ਕਰਜ਼ੇ ਦੀ ਵਜ੍ਹਾ ਕਰਕੇ ਲੋਕ ਆਪਣੀ ਚਾਦਰ ਤੋਂ ਵੱਧ ਵੀ ਪੈਰ ਪਸਾਰ ਲੈਂਦੇ ਨੇ ਵੀ ਸਾਨੂੰ ਕਰਜ਼ਾ ਆਸਾਨੀ ਨਾਲ ਮਿਲ ਜਾਵੇਗਾ ਅਤੇ ਮੈਂ ਇਹ ਕੰਮ ਜਿਹੜਾ ਧੂਮ ਧਾਮ ਨਾਲ ਕਰਾਂ ਜੇ ਕਰਜ਼ਾ ਨਾ ਹੋਵੇਗਾ ਫਿਰ ਉਹ ਆਪਣੇ ਉਨੇ ਕੁ ਹੀ ਪ੍ਰੋਗਰਾਮ ਵੀ ਕਰਨਗੇ ਸਤਿ ਸ਼੍ਰੀ ਅਕਾਲ ਜੀ